ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਹੈ ਜਿਸ ਨਾਲ ਪੰਜਾਬੀ ਬੋਲਣ ਵਾਲਿਆਂ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚੋਂ ਇੱਕ ਪੰਜਾਬੀ ਭਾਸ਼ਾ ਇਹੋ ਜਿਹੀ ਹੈ ਜੋ ਕਿ ਬਹੁਤ ਜ਼ਿਆਦਾ ਸਮਝ ਅਤੇ ਸੁਣਨ ਵਿੱਚ ਮੋਹ ਮੋਹ ਵਾਲੀ ਭਾਸ਼ਾ ਹੈ ਜਿਸ ਨਾਲ ਪੰਜਾਬੀ ਵਿੱਚ ਪੰਜਾਬੀ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ 'ਤੇ ਜਾ ਬਹੁਤ ਜ਼ਿਆਦਾ ਮਾਣ ਹੈ ਇਸ ਲਈ ਪੰਜਾਬੀਆਂ ਪੰਜਾਬੀ ਦੀ ਭਾਸ਼ਾ ਹੋਰ ਸਟੇਟਾਂ ਵਿੱਚ ਜਿਵੇਂ ਰਾਜਸਥਾਨ ਬੰਗਾਲ ਬਿਹਾਰ ਵਾਲਿਆਂ ਨੂੰ ਬਹੁਤ ਜਲਦੀ ਪੰਜਾਬੀ ਬੋਲਣ ਵਿੱਚ ਕੋਈ ਬਾਹਲੀ ਕਠਿਨਾਈ ਨਹੀਂ ਹੁੰਦੀ ਇਸ ਲਈ ਪੰਜਾਬੀ ਬੋਲੀ ਵਿੱਚ ਜੋ ਵੀ ਪੰਜਾਬ ਵਿੱਚ ਰਹਿ ਜਾਂਦਾ ਹੈ ਉਹ ਪੰਜਾਬੀ ਬੋਲਣ ਤੋਂ ਵਾਂਝਾ ਨਹੀਂ ਰਹਿੰਦਾ ਇਸ ਲਈ ਪੰਜਾਬੀ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਇਸ ਲਈ ਪੰਜਾਬੀ ਨੂੰ ਅਸੀਂ ਬਹੁਤ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਮਾਂ ਬੋਲੀ ਨਾਲ ਹੀ ਪਸੰਦ ਕਰਦੇ ਹਾਂ ਇਸ ਲਈ ਸਾਨੂੰ ਆਪਣੀ ਪੰਜਾਬੀ ਬੋਲੀ 'ਤੇ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਜੀ ਧੰਨਵਾਦ